ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਾਡੇ ਕੋਲ਼ ਸਾਰੀ ਤਰ੍ਹਾਂ ਦੀਆਂ ਜੁੱਤੀਆਂ ਹੈਗੀਆਂ ਜਿਵੇਂ ਕਿ ਜਿਵੇਂ ਕਿ ਪੰਜਾਬੀ ਜੁੱਤੀ ਹੋ ਗਈ ਹੀਲਜ਼ ਵਾਲੀ ਹੋ ਗਈ ਅਤੇ ਫਲੈਟ ਜੁੱਤੀ ਵੀ ਹੈ ਕਿਨ੍ਹਾਂ ਦਾ ਪੰਜਾਬੀ ਜੁੱਤੀ ਦੇ ਅਲੱਗ ਅਲੱਗ ਪ੍ਰਾਈਜ਼ ਐਂ ਜਿਵੇਂ ਕਿ ਸਾਡੇ ਕੋਲ ਪੰਜਾਬੀ ਜੁੱਤੀ ਵੀ ਕਈ ਤਰ੍ਹਾਂ ਦੀ ਹੈ ਜਿਵੇਂ ਕਿ ਘੁੰਗਰੂਆਂ ਵਾਲ਼ੀ ਹੋ ਗਈ ਇੱਕ ਕਢਾਈ ਵਾਲ਼ੀ ਵੀ ਹੈ ਇੱਕ ਪਟਿਆਲੇ ਵਾਲੀ ਵੀ ਹੈ ਹਾਂਜੀ ਸਭ ਦੇ ਅਲੱਗ ਅਲੱਗ ਪ੍ਰਾਈਜ਼ ਹੈ 'ਤੇ ਬੈਲੀ ਵੀ ਹੈਗੀ ਹੈ ਸਾਡੇ ਕੋਲ ਹਾਂਜੀ ਸਲੀਪਰਸ ਵੀ ਆ ਜਾਣਗੇ ਸਲੀਪਰਸ ਆਪਣੇ ਹੁੰਦੇ ਏ ਪੰਜ ਸੌ ਤੋਂ ਸਟਾਰਟਿੰਗ ਹੈ ਹਾਂਜੀ ਹਾਂਜੀ ਬੋਆਇਜ਼ ਦੇ ਵੀ ਹੈਗੇ ਐਂ ਬੋਆਇਜ਼ ਦੀ ਵੀ ਬੈਲੀ ਆਉਂਦੀ ਹੁੰਦੀ ਹੈ ਅਤੇ ਉਹ ਵੀ ਹੈਗੀ ਆ ਇੱਕ ਬੋਆਇਜ਼ ਦੀ ਪੰਜਾਬੀ ਜੁੱਤੀ ਵੀ ਆਉਂਦੀ ਹੁੰਦੀ ਹੈ ਉਹ ਵੀ ਮਿਲਜੂਗੀ ਅਤੇ ਹੋਰ ਸਪੋਰਟਸ ਸ਼ੂਜ਼ ਵੀ ਆ ਜਾਂਦੇ ਹੁੰਦੇ ਹੈ ਹਾਂਜੀ ਅਤੇ ਬਾਕੀ ਜੇ ਤੁਸੀਂ ਲੈਣੇ ਹੋਏ ਤਾਂ ਦ ਤੁਸੀਂ ਸ਼ੋਪ ਪਰ ਆ ਸਕਦੇ ਹਾਂ ਕੱਲ੍ਹ ਨੂੰ

ਹਾਂਜੀ ਕੱਲ੍ਹ ਪਤਾ ਕਰ ਲਿਓ ਹਾਂਜੀ ਓਕੇ ਜੀ ਥੈਂਕ ਯੂ